ਮੇਰਾ ਨਾਮ ਰਾਘਵ ਹੈ ਮੈਂ ਪਠਾਨਕੋਟ ਸ਼ਹਿਰ ਦਾ ਰਹਿਣ ਵਾਲਾ ਹਾਂ ਮੈਂ ਆਪ ਜੀ ਨੂੰ ਇੱਕ ਕਿੱਸਾ ਸੁਣਾਉਨਾ ਚਾਹੁੰਦਾ ਹਾਂ ਜਿਸ ਵਿੱਚ ਮੈਂ ਆਪਣੇ ਪਰਿਵਾਰ ਨਾਲ ਕ੍ਰਿਕਟ ਦਾ ਮੈਚ ਦੇਖਣ ਲਈ ਧਰਮਸ਼ਾਲਾ ਗਿਆ ਸੀ ਉਦੋਂ ਮੈਂ ਕੁਝ ਪੰਦਰਾਂ ਕੁ ਸਾਲਾਂ ਦਾ ਸੀ ਅਤੇ ਮੈਂ ਅਤੇ ਮੇਰਾ ਪਰਿਵਾਰ ਧਰਮਸਟਾਲਾ ਸਟੇਡੀਅਮ ਵਿੱਚ ਕ੍ਰਿਕਟ ਦਾ ਮੈਚ ਦੇਖਣ ਗਏ ਸੀ ਉਦੋਂ ਇੰਡੀਆ ਵਰਸਿਸ ਬਾਂਗਲਾਦੇਸ਼ ਦਾ ਮੈਚ ਸੀ ਤਾਂ ਇਗਲਾ ਬਾਂਗਲਾਦੇਸ਼ ਦੀ ਬੈਟਿੰਗ ਹੋ ਗਈ ਅਤੇ ਅਸੀਂ ਇੰਡੀਆ ਦੀ ਬੈਟਿੰਗ ਦੇਖਣ ਲਈ ਉੱਥੇ ਰੁਕੇ ਸੀ ਇੰਡੀਆ ਨੇ ਬਹੁਤ ਵਧੀਆ ਖੇਡਿਆ ਅਤੇ ਉਹ ਜਿੱਤੀ ਮੈਂ ਅਤੇ ਮੇਰਾ ਪਰਿਵਾਰ ਬਹੁਤ ਖੁਸ਼ ਸੀ ਕਿ ਇੰਡੀਆ ਜਿੱਤ ਗਈ ਹੈ ਇਸ ਕਰਕੇ ਮੈਚ ਦੇਖ ਕੇ ਅਸੀਂ ਉੱਥੇ ਬਹੁਤ ਇੰਜੋਏ ਕੀਤਾ ਅਤੇ ਮੈਂ ਉੱਥੇ ਧੋਨੀ ਨੂੰ ਵੀ ਪਹਿਲੀ ਵਾਰ ਦੇਖਿਆ ਸੀ ਮੈਨੂੰ ਬਹੁਤ ਵਧੀਆ ਲੱਗਿਆ ਫਿਰ ਅਸੀਂ ਮੈਚ ਦੇਖ ਕੇ ਵਾਪਿਸ ਆਉਂਦੇ ਵੇਲੇ ਕੈ ਕਈ ਕੋਈ ਨਜ਼ਾਰੇ ਪਹਾੜੀ ਨਜ਼ਾਰੇ ਖਾਣ ਪੀਣ ਦੀ ਚੀਜ਼ਾਂ ਬੜੀ ਵੱਖਰੀ ਵੱਖਰੀ ਚੀਜ਼ਾਂ ਖਾਦੀਆਂ ਅਤੇ ਕੁਛ ਖੇਡਣ ਲਈ ਬੈਟ ਬੋਲ ਅਤੇ ਇੰਡੀਆ ਦੀ ਜਰਸੀਆਂ ਵਗੈਰਾ ਉੱਥੋਂ ਲਿੱਤੀਆਂ ਅਤੇ ਵਾਪਿਸ ਆ ਗਏ ਮੈਂ ਤਾਂ ਇਹ ਹੀ ਕਹਾਂਗਾ ਕਿ ਸਾਨੂੰ ਸਾਰਿਆਂ ਨੂੰ ਆਪਣੇ ਪਰਿਵਾਰ ਨਾਲ ਤੁਸੀਂ ਕਈ ਜਗ੍ਹਾ 'ਤੇ ਘੁੰਮਣਾ ਚਾਹੀਦਾ ਹੈ ਅਤੇ ਵੱਖਰਾ ਵੱਖਰਾ ਅਨੁਭਵ ਲੈਣਾ ਚਾਹੀਦਾ ਹੈ ਜਿਵੇਂ ਮੈਂ ਆਪਣੇ ਪਰਿਵਾਰ ਨਾਲ ਕ੍ਰਿਕਟ ਮੈਚ ਦੇਖਣ ਦਾ ਅਨੁਭਵ ਕੀਤਾ